ਹੈਲੋ ਹਾਂਜੀ ਭਾਅ ਜੀ ਹਾਂਜੀ ਹਾਂਜੀ ਭਾਅ ਜੀ ਮੋਹਾਲੀ ਤੋਂ ਗੱਲ ਕਰ ਰਹੇ ਹਾਂ ਜੀ ਨਹੀਂ ਭਾਅ ਜੀ ਉਹ ਆਪਣਾ ਨਹੀਂ ਹੈ ਪਰ ਆਪਾਂ ਇੱਥੇ ਲੋਕਲ ਹੀ ਰਹਿੰਦੇ ਹਾਂ ਆਪਾਂ ਨੂੰ ਉਹਦੇ ਬਾਰੇ ਜਾਣਕਾਰੀ ਹੈਗੀ ਹੈ ਜੀ ਦੇਖੋ ਭਾਅ ਜੀ ਪਹਿਲੀ ਗੱਲ ਤਾਂ ਜੀ ਇਹ ਜਿਹੜਾ ਢਾਬਾ ਇਹਦੀ ਲੋਕੇਸ਼ਨ ਹੈਗੀ ਹੈ ਜੀ ਪੰਜ ਫੇਸ ਜਦੋਂ ਨਾ ਜੀ ਤੁਸੀਂ ਲਾਈਟਾਂ ਤੋਂ ਖੱਬੇ ਮੁੜੋਂਗੇ ਨਾਲ ਹੀ ਸੱਜੇ ਮੁੜ ਕੇ ਜੀ ਪਹਿਲੀ ਉਹ ਮਾਰਕੀਟ 'ਚ ਹੈ ਇਹ ਇਹ ਠੀਕ ਹੈ ਜੀ ਇਹਦੀ ਫੂਡ ਕੁਆਲੀਟੀ ਬੜੀ ਵਧੀਆ ਹੈ ਜੀ ਅਤੇ ਜਿੰਨੇ ਵੀ ਫੂਡ ਰੈਸਟੋਰੈਂਟ ਹੈ ਜ਼ਿਆਦਾਤਰ ਉੱਥੇ ਜਾਣਾ ਪਸੰਦ ਕਰਦੇ ਹਾਂ ਜੀ ਪੰਜ ਫੇਸ 'ਚ ਹੈ ਜੀ ਫਰਸਟ ਪ੍ਰੈਫਰੈਂਸ ਉੱਥੇ ਮਤਲਬ ਦਿੰਦੇ ਹਾਂ ਜੀ ਜਾਣੀ ਕੇ ਕਿਉਂਕਿ ਇੱਕ ਤਾਂ ਉਹਨਾਂ ਦੇ ਸਾਫ਼ ਸਫ਼ਾਈ ਬਹੁਤ ਹੁੰਦੀ ਹੈ ਜੀ ਅਤੇ ਨੰਬਰ ਦੋ ਜੀ ਇੱਕ ਤਾਂ ਹਾਂਜੀ ਹਾਂਜੀ ਭਾਅ ਜੀ ਉੱਥੇ 'ਤੇ ਨੇੜੇ ਹੀ ਹੈ ਜਿਵੇਂ ਕਿ ਸੱਤ ਅੱਠ ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਹੈ ਤੁਸੀਂ ਉੱਥੇ 'ਤੇ ਬਾਏ ਕੈਬ ਵੀ ਜਾ ਸਕਦੇ ਹੋ ਅਤੇ ਪਬਲਿਕ ਟਰਾਂਸਪੋਰਟ ਹੋ ਗਈ ਜਿਵੇਂ ਬੱਸ ਵਗੈਰਾ ਵੀ ਯੂਜ਼ ਕਰ ਸਕਦੇ ਹੋ ਉਹ ਮਤਲਬ ਤੁਹਾਡੇ 'ਤੇ ਡਿਪੈਂਡ ਹੈ ਵੀ ਤੁਸੀਂ ਕਿਵੇਂ ਹੋ ਅਤੇ ਕਿਵੇਂ ਡੀਲ ਕਰਦੇ ਹੋ ਹੈ ਨਾ ਹਾਂਜੀ ਹਾਂਜੀ ਭਾਅ ਜੀ ਫੂਡ ਬੜਾ ਵਧੀਆ ਦਿੰਦੇ ਹੈ ਅਤੇ ਨੰਬਰ ਇੱਕ 'ਤੇ ਗੱਲ ਇਹ ਵੀ ਹੈ ਇਹਨਾਂ ਦਾ ਫੂਡ ਖਾ ਕੇ ਬੰਦਾ ਕਦੇ ਵੀ ਬਿਮਾਰ ਨਹੀਂ ਹੁੰਦਾ ਅਤੇ ਬਹੁਤ ਹੀ ਫਰੈਸ਼ ਫੂਡ ਦਿੰਦੇ ਹੈ ਜੀ ਜਿਸ ਨਾਲ ਕਿ ਬਹੁਤ ਜ਼ਿਆਦਾਤਰ ਲੋਕ ਇਕੱਠੇ ਹੋਣਾ ਪਸੰਦ ਕਰਦੇ ਨੇ ਜੀ ਜਿੰਨੇ ਵੀ ਟੂਰੈਸਟ ਸਾਰੇ ਇੱਥੇ ਆ ਕੇ ਸਟੇਅ ਕਰਦੇ ਨੇ ਹਾਂਜੀ ਵੈੱਜ ਵੀ ਨੋਨ ਵੈੱਜ ਇੱਥੇ ਇਹਨਾਂ ਦੇ ਬੱਫੇ ਸਿਸਟਮ ਵੀ ਹੈ ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਬਾਕੀ ਇੱਦਾਂ ਹੈ ਜੀ ਇਹਨਾਂ ਦੇ ਪਲੇਟ ਸਿਸਟਮ ਵੀ ਹੈ ਜਿਵੇਂ ਨਹੀਂ ਨਹੀਂ ਭਾਅ ਜੀ ਐਡਾ ਐਕਸਪੈਂਸਿਵ ਨਹੀਂ ਹੈਗਾ ਮਤਲਬ ਲੈੱਸ ਐਕਸਪੈਂਸਿਵ ਹੈ ਮਤਲਬ ਐਵੇਂ ਨਹੀਂ ਵੀ ਕੋਈ ਅਫੋਰਡ ਨਹੀਂ ਕਰ ਸਕਦਾ ਠੀਕ ਹੈ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਜੀ ਠੀਕ ਹੈ ਭਾਅ ਜੀ ਓਕੇ ਥੈਂਕ ਯੂ ਜੀ